ਮੇਰਾ ਮਨਪਸੰਦ ਮੌਸਮ ਸਾਵਨ ਦਾ ਹੈ ਇਹ ਮੌਸਮ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਕਿਉਂਕਿ ਇਹ ਮੌਸਮ ਦੇ ਵਿੱਚ ਨਾ ਹੀ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਹੈ ਨਾ ਹੀ ਜ਼ਿਆਦਾ ਠੰਡ ਅਤੇ ਬਾਰਿਸ਼ ਬਾਰਿਸ਼ ਦਾ ਅਲੱਗ ਹੀ ਮਜ਼ਾ ਹੈ ਅਸੀਂ ਆਪਣੇ ਪਰਿਵਾਰ ਦੇ ਨਾਲ ਇਕੱਠੇ ਬਹਿ ਕੇ ਪਕੌੜਿਆਂ ਦਾ ਮਜ਼ਾ ਲੈ ਸਕਦੇ ਹਨ ਚਾਹ ਪਕੌੜੇ ਅਤੇ ਮੈਨੂੰ ਇਹ ਮੌਸਮ ਇਹ ਵੀ ਚੰਗਾ ਲੱਗਦਾ ਹੈ ਕਿਉਂਕਿ ਇਸ ਦੇ ਵਿੱਚ ਸਾਨੂੰ ਸਾਡਾ ਆਸਮਾਨ ਪੂਰਾ ਸਾਫ ਦਿਖਦਾ ਅਤੇ ਸਾਡੀ ਧਰਤੀ ਸਾਫ ਹੋ ਜਾਂਦੀ ਹੈ ਅਤੇ ਇਹ ਮੌਸਮ ਆਪੋ ਆਪ ਦੇ ਵਿੱਚ ਇੱਕ ਖਾਸ ਮੌਸਮ ਹੈ ਕਿਉਂਕਿ ਇਸ ਮੌਸਮ ਦੇ ਵਿੱਚ ਅਸੀਂ ਸ਼ਿਵਜੀ ਦੀ ਪੂਜਾ ਵੀ ਕਰਦੇ ਹਾਂ ਅਤੇ ਲੜਕੀਆਂ ਵਰਤ ਵੀ ਰੱਖਦੀਆਂ ਅਤੇ ਇਹ ਕਾਫੀ ਪਵਿੱਤਰ ਸਮਾਂ ਕਹਿ ਸਕਦੇ ਹਨ ਜਿਸ ਦੇ ਵਿੱਚ ਹਰ ਕਿਸੇ ਦੀ ਮੁਰਾਦ ਪੂਰੀ ਹੁੰਦੀ ਹੈ ਲੋਕੀ ਕਿਰਤ ਕਰਦੇ ਹੈ ਅਤੇ ਹੋਰ ਵੀ ਕਈ ਕਈ ਚੀਜ਼ਾਂ ਉਹ ਕਰਦੇ ਹਨ ਸਾਵਨ ਦਾ ਮਹੀਨਾ ਆਉਣ 'ਤੇ ਮੋਰ ਨੱਚਦੇ ਟੱਪਦੇ ਹਨ ਅਤੇ ਔਰ ਅਤੇ ਡੱਡੂਆਂ ਬੋਲਦੇ ਹਨ ਬਹੁਤ ਕੁਛ ਮੈਨੂੰ ਇਸ ਕਰਕੇ ਸਾਵਨ ਦਾ ਮਹੀਨਾ ਬਹੁਤ ਚੰਗਾ ਲੱਗਦਾ ਹੈ ਬਾਰਿਸ਼ ਦਾ ਮੌਸਮ ਅਤੇ ਉਹਦੇ ਅਲੱਗ ਹੀ ਮਜ਼ੇ